ਹਾਂ ਪਸ਼ੂਆਂ ਦਾ ਬਹੁਤ ਪਸ਼ੂਆਂ ਦਾ ਮੌਸਮ ਮੌਸਮ ਦਾ ਪਸ਼ੂਆਂ ਉੱਤੇ ਬਹੁਤ ਸਾਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਜਿਆਦਾ ਗਰਮੀ ਜਾਂ ਜ਼ਿਆਦਾ ਸਰਦੀ ਹੋਣ ਕਰਕੇ ਪਸ਼ੂ ਬਿਮਾਰ ਹੋ ਜਾਂਦੇ ਹਨ ਇਹਦੇ ਦੋ ਕਈ ਕਾਰਨ ਹੋ ਸਕਦੇ ਹਨ ਕਈ ਵਾਰ ਜਿਵੇਂ ਕਿ ਦਸੰਬਰ ਦੇ ਮਹੀਨੇ ਵਿੱਚ ਪਸ਼ੂਆਂ ਦਾ ਖੁੱਲ੍ਹੇ ਥਾਂ ਵਿੱਚ ਰਹਿਣ ਕਰਕੇ ਉਹਨਾਂ ਨੂੰ ਸਰਦੀ ਲੱਗ ਜਾਂਦੀ ਹੈ ਅਤੇ ਗਰਮੀ ਵਿੱਚ ਕਈ ਵਾਰ ਪਸ਼ੂਆਂ ਨੂੰ ਲੋ ਲੱਗ ਜਾਂਦੀ ਹੈ ਜਿਸ ਕਰਕੇ ਉਹ ਬਿਮਾਰ ਹੋ ਜਾਂਦੇ ਹਨ ਕਈ ਵਾਰ ਪਸ਼ੂ ਮੀਂਹ ਵਿੱਚ ਖੜ੍ਹੇ ਹੋਣ ਕਰਕੇ ਉਹਨੂੰ ਗਰਮ ਸਰਦ ਹੋ ਜਾਂਦਾ ਹੈ ਜਿਵੇਂ ਕਈ ਵਾਰ ਪਸ਼ੂ ਗੜੇਮਾਰੀ ਵਿੱਚ ਆ ਜਾਂਦੇ ਹਨ ਅਤੇ ਉਹਨਾਂ ਦਾ ਟੈਂਪਰੇਚਰ ਡਿੱਗ ਪੈਂਦਾ ਹੈ ਅਤੇ ਉਹ ਗਰਮ ਸਰਦ ਹੋ ਜਾਂਦੇ ਹਨ ਜਿਸ ਕਰਕੇ ਉਹ ਬਿਮਾਰ ਹੋ ਜਾਂਦੇ ਹਨ ਇਹਦੇ ਕਰਕੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਜਿਵੇਂ ਕਿ ਉਹਨਾਂ ਦੀ ਗੁਣਵੱਤਾ ਦੁੱਧ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਦੁੱਧ ਦੀ ਕੁਆਂ ਕੁਆਂਟਿਟੀ ਵੀ ਘੱਟ ਜਾਂਦੀ ਹੈ ਜਿਵੇਂ ਕਈ ਪਸ਼ੂ ਗਰਮੀ ਵਿੱਚ ਆਉਣ ਕਰਕੇ ਦੁੱਧ ਘਟਾ ਜਾਂਦੇ ਹਨ ਅਤੇ ਉਹਨਾਂ ਦਾ ਦੁੱਧ ਦੁੱਧ ਦੇ ਵਿੱਚ ਜਿਹੜੀ ਫੈਂਟ ਆਉਂਦੀ ਹੈ ਉਹ ਵੀ ਘੱਟ ਜਾਂਦੀ ਹੈ ਜ਼ਿਆਦਾ ਸਰਦੀਆਂ ਵਿੱਚ ਵੀ ਪਸ਼ੂ ਆਪਣਾ ਦੁੱਧ ਘਟਾ ਜਾਂਦੇ ਹਨ ਅਤੇ ਉਹਨਾਂ ਦੀ ਫੈਂਟ ਦਾ ਵੀ ਫਰਕ ਪੈਂਦਾ ਹੈ ਪਰ ਜਦੋਂ ਮੌਸਮ ਵਧੀਆ ਹੁੰਦਾ ਹੈ ਉਦੋਂ ਉਹਨਾਂ ਦੇ ਦੁੱਧ ਦੀ ਗੁਣਵੱਤਾ ਵੱਧ ਜਾਂਦੀ ਹੈ ਅਤੇ ਉਹਨਾਂ ਦੀ ਫੈਂਟ ਵੀ ਵਧੀਆ ਆਉਂਦੀ ਹੈ